ਹਾਂਜੀ ਮੈਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਸਨ ਜਿਸ ਨੇ ਮੈਨੂੰ ਮਤਲਬ ਆਪੋ ਸੋਚਣ 'ਤੇ ਸਮਾਂ ਉਹ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਕਿ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਕਿਤਾਬਾਂ ਪੜ੍ਹੀਆਂ ਸਾਰੀਆਂ ਜਿਹਦੇ ਵਿੱਚ ਕਿ ਮੈਂ ਇੱਕ ਹਿੰਦੀ ਦੀ ਕਿਤਾਬ ਪੜ੍ਹੀ ਸੀ ਜਿਸ ਦੇ ਨਾਂ ਸੀ ਹਿਮਾਲਿਆ ਸੰਤ ਇਸ ਕਿਤਾਬ ਦੇ ਜ਼ਿਆਦਾ ਤੋਂ ਜ਼ਿਆਦਾ ਛੱਬੀ ਸੌ ਪੰਨੇ ਸਨ ਜਿਹਦੇ ਵਿੱਚ ਮੈਨੂੰ ਪੜ੍ਹਨ ਤੋਂ ਇਸਦੇ ਪੜ੍ਹਨ ਵਾਸਤੇ ਮੈਨੂੰ ਜ਼ਿਆਦਾ ਦੋ ਮਹੀਨੇ ਲੱਗੇ ਸੀਗੇ ਇਹਦੇ ਵਿੱਚ ਮੈਨੂੰ ਬਹੁਤ ਸਾਰੀ ਸਿੱਖਿਆ ਮਿਲੀਆਂ ਇਸਨੂੰ ਮੈਨੂੰ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਸੋਚਣ 'ਤੇ ਮਤਲਬ ਮਜ਼ਬੂਰ ਕਰ ਦਿੱਤਾ ਮਤਲਬ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਹ ਦੱਸਿਆ ਗਿਆ ਸੀ ਕਿ ਸਾਡੇ ਚਾਰ ਜਨਮ ਤੋਂ ਲੈ ਕੇ ਮਰਨ ਤੱਕ ਸਾਰੀਆਂ ਘਟਨਾਵਾਂ ਦੱਸੀਆਂ ਗਈਆਂ ਸਾਡੇ ਕਰਮਾਂ ਬਾਰੇ ਦੱਸਿਆ ਗਿਆ ਅਸੀਂ ਕੀ ਕਰਦੇ ਹਾਂ ਸਾਡੀ ਆਤਮਾ ਬਾਰੇ ਦੱਸਿਆ ਗਿਆ ਸਾਡੇ ਸਰੀਰ ਬਾਰੇ ਦੱਸਿਆ ਗਿਆ ਵੀ ਸਾਡੇ ਨਾਲ ਕੀ ਹੁੰਦਾ ਹੈ ਸਾਡੀ ਜਵਾਨੀ ਬਾਰੇ ਦੱਸਿਆ ਗਿਆ ਬੁਢਾਪੇ ਬਾਰੇ ਆਦਿ ਬਚਪਨ ਬਾਰੇ ਸਾਰਾ ਕੁਛ ਦੱਸਿਆ ਗਿਆ ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਸਾਡੇ ਮਰਨ ਤੋਂ ਬਾਅਦ ਸਾਡੇ ਨਾਲ ਕੀ ਕੁਛ ਹੁੰਦਾ ਹੈ ਜਿਹੜੇ ਕਿ ਸਾਡੇ ਸਵਰਗ ਨਰਕ ਆਦਿ ਹੁੰਦੇ ਸਨ ਉਹਦੇ ਵਿੱਚ ਸਾਡੇ ਨਾਲ ਕਿਹੋ ਜਿਹਾ ਵਰਤਾਅ ਕੀਤਾ ਜਾਂਦਾ ਇਹ ਸਾਡੇ ਕਰਮਾਂ 'ਤੇ ਨਿਰਭਰ ਕਰਦਾ ਹੈ ਜਿਹੋ ਜੇ ਅਸੀਂ ਕਰਮ ਕਰਦੇ ਹਾਂ ਉਹ ਜਿਹੇ ਸਾਡੇ ਨਾਲ ਵਰਤਾਅ ਕੀਤਾ ਜਾਂਦਾ ਇਸ ਵਰਗ ਜਾਂ ਨਰਕ ਦੇ ਵਿੱਚ ਜਾਣਾ ਉੱਥੇ ਕਿਹੋ ਜਿਹੀ ਮਤਲਬ ਵਤੀਰਾ ਕੀਤਾ ਜਾਂਦਾ ਅਗਾਂਹ ਸਾਨੂੰ ਕਿਹੜੀ ਜੂਨ ਮਿਲਦੀ ਹੈ ਕਿਹੋ ਜਿਹੀ ਜਿੰਦਗੀ ਮਿਲਦੀ ਆ ਆਦਿ ਇਸ ਬੁੱਕ ਵਿੱਚ ਦੱਸਿਆ ਗਿਆ ਇਹ ਜਿੰਦਗੀ ਬਾਰੇ ਮਤਲਬ ਸਾਨੂੰ ਸਾਰਾ ਕੁਝ ਸਿਖਾਉਂਦੀ ਆ ਇਹਦੇ ਵਿੱਚ ਸਾਨੂੰ ਮਤਲਬ ਆਪਣੀ ਜ਼ਿੰਦਗੀ ਦੇ ਕਿਹੜੀ ਜੂਨ ਪੈਣਾ ਇਹ ਆਦਿ ਸਾਨੂੰ ਸਾਰਾ ਕੁਝ ਇਸ ਵਿੱਚ ਦੱਸਿਆ ਗਿਆ ਸੀਗਾ ਇਹਦੀ ਕਿਤਾਬ ਸਨ ਮੈਨੂੰ ਬਹੁਤ ਹੀ ਵਧੀਆ ਅਤੇ ਰੇਡੀਓ ਕਲੱਬ ਵਿੱਚ ਅੱਜ ਤੱਕ ਮੈਂ ਕਿਸੇ ਵਿੱਚ ਵੀ ਸ਼ਾਮਿਲ ਨਹੀਂ ਹੋਈ